ਮੇਰਾ ਘਰ ਸ਼ਹਿਰ ਵਿੱਚ ਹੈ ਅਤੇ ਮੈਂ ਆਪਣੇ ਕੰਮਕਾਰਾਂ ਕਰਕੇ ਜ਼ਿਆਦਾਤਰ ਸ਼ਹਿਰ ਵਿੱਚ ਹੀ ਰਹਿੰਦਾ ਹਾਂ ਪਰ ਮੇਰੇ ਚਾਚੇ ਦਾ ਘਰ ਪਿੰਡਾਂ ਪਿੰਡ ਵਿੱਚ ਹੈ ਅਤੇ ਮੈਨੂੰ ਪਿੰਡ ਦਾ ਦੌਰਾ ਕਰਨ ਵਿੱਚ ਬਹੁਤ ਆਨੰਦ ਆਉਂਦਾ ਹੈ ਇਸ ਲਈ ਮੈਂ ਹਰ ਹਫ਼ਤੇ ਆਪਣੇ ਚਾਚਾ ਦੇ ਕੋਲ ਜਾਂਦਾ ਹਾਂ ਅਤੇ ਪਿੰਡ ਦਾ ਦੌਰਾ ਕਰਕੇ ਆਉਂਦਾ ਹਾਂ ਇਸ 'ਤੇ ਪਿੰਡ ਦੇ ਦੌਰੇ ਕਰਨ ਨਾਲ ਸਾਨੂੰ ਕਈ ਲਾਭਦਾਇਕ ਚੀਜ਼ਾਂ ਵੀ ਮਿਲਦੀਆਂ ਹਨ ਨੇੜਲੇ ਪਿੰਡਾਂ ਦਾ ਦੌਰਾ ਸਮਾਜਿਕ ਸਿਰਜਣਾ ਅਤੇ ਲੋਕ ਸੰਰਪਾ ਸੰਪਰਕ ਦੀ ਬੜੋਤਰੀ ਲਈ ਕੀਤਾ ਜਾਂਦਾ ਹੈ ਇਸ ਨਾਲ ਅਸੀਂ ਕਾਫੀ ਲੋਕਾਂ ਦੇ ਨਾਲ ਸੰਪਰਕ ਵਿੱਚ ਆਉਂਦੇ ਹਨ ਇਸ ਨਾਲ ਲੋਕ ਇੱਕ ਦੂਜੇ ਨਾਲ ਮਿਲਦੇ ਹਨ ਅਤੇ ਜਾਣ ਪਛਾਣ ਵਧਦੀ ਹੈ ਅਤੇ ਅਸੀਂ ਆਪਣੇ ਕਰਤਿਆਂ ਘਰਦਿਆਂ ਪਰਿਵਾਰ ਦੀ ਸਥਿਤੀ ਦਾ ਪਤਾ ਲਗਾਉਂਦੇ ਹਾਂ ਅਤੇ ਸਮੂ ਸਮੁੱਚੀ ਸਮੂਹ ਵਤਾਵਾਂ ਦਾ ਸਹਿਯੋਗ ਵੀ ਕਰਦੇ ਹਾਂ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਪਿੰਡ ਦੇ ਲੋਕ ਕਿਵੇਂ ਜ਼ਿੰਦਗੀ ਜਿਉਂਦੇ ਹਨ ਅਤੇ ਉਹਨਾਂ ਵਿੱਚ ਉਹਨਾਂ ਦੇ ਪਿੰਡ ਵਿੱਚ ਕੀ ਕੀ ਨੁਕਸਾਨ ਹਨ ਅਤੇ ਕੀ ਕੀ ਚੰਗੀਆਂ ਚੀਜ਼ਾਂ ਹਨ ਜਿਵੇਂ ਕਿ ਉੱਧਰ ਸਾਹ ਬਹੁਤ ਵਧੀਆ ਆਉਂਦਾ ਹੈ ਅਤੇ ਪੇੜ ਪੁੜ ਪੇੜ ਪੇੜ ਸਹੀ ਲੱਗੇ ਹੋਏ ਹਨ ਅਤੇ ਇੱਧਰ ਦਾ ਸਾਰਾ ਕੁਝ ਤੇਸੀ ਦੇਸੀ ਢੰਗ ਨਾਲ ਕੀਤਾ ਜਾਂਦਾ ਹੈ ਜੋ ਕਿ ਮੈਨੂੰ ਕਾਫੀ ਵਧੀਆ ਲੱਗਦਾ ਹੈ ਅਤੇ ਇੱਧਰ ਦੀ ਹਵਾ ਕਾਫੀ ਸ਼ੁੱਧ ਵੀ ਹੈ ਜਿਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਅਤੇ ਬਸ